ਹਾਂਜੀ ਮੈਂ ਐੱਮ ਏ ਦੇ ਵਿੱਚ ਇੱਕ ਕਿਤਾਬ ਪੜ੍ਹੀ ਸੀਗੀ ਕਿਰਪਾਲ ਸਿੰਘ ਘੁੰਮਣ ਨਾਂ ਦੇ ਇੱਕ ਲੇਖਕ ਨੇ ਆਓ ਹੱਸੀਏ ਬਹੁਤ ਹੀ ਸੋਹਣੀ ਕਿਤਾਬ ਸੀਗੀ ਅਤੇ ਬਹੁਤ ਹੀ ਜਦੋਂ ਤੁਸੀਂ ਕਹਿ ਲਉ ਬਹੁਤ ਬਹੁਤ ਜਿਹੜਾ ਬਹੁਤ ਅਸਲ ਸੱਚਾਈਆਂ ਜਿਹੜੀਆਂ ਹੈਗੀਆਂ ਜ਼ਿੰਦਗੀ ਦੇ ਤਜ਼ਰਬਿਆਂ ਦੇ ਵਿੱਚ ਆਉਂਦੀ ਜਿਹੜੀ ਹੈਗੀ ਆ ਉਹ ਪੇਂਡੂ ਤਜ਼ਰਬਿਆਂ ਦੇ ਵਿੱਚੋਂ ਖ਼ਾਸ ਤੌਰ 'ਤੇ ਜਿਹੜੀ ਉਹ ਕਿਤਾਬ ਉਨ੍ਹਾਂ ਨੇ ਲਿਖੀ ਕਿ ਪਿੰਡਾਂ ਦੇ ਲੋਕ ਜਿਹੜੇ ਹੈਗੇ ਨੇ ਉਹ ਕਿਵੇਂ ਇੱਕ ਦੂਜੇ ਨਾਲ ਕੰਮਕਾਰ ਕਰਦੇ ਇੱਕ ਦੂਜੇ ਨਾਲ ਹੱਸਦੇ ਖੇਡਦੇ ਜੀਵਨ ਜਿਊਂਦੇ ਉਨ੍ਹਾਂ ਗੱਲਾਂ ਦੇ ਵਿੱਚੋਂ ਜਦੋਂ ਇੱਕ ਦੂਜੇ ਦੇ ਜਵਾਬ ਦਿੰਦੇ ਉਹ ਕਿਵੇਂ ਗੱਲਾਂ ਨੂੰ ਹਾਸੇ ਦੇ ਵਿੱਚ ਪਾ ਦਿੰਦੇ ਹੈ ਅਤੇ ਉਹ ਕਿਤਾਬ ਪੜ੍ਹ ਕੇ ਸਹਿਜ ਵੀ ਬਹੁਤ ਮਹਿਸੂਸ ਹੋਇਆ ਅਤੇ ਹਾਸਾ ਵੀ ਬਹੁਤ ਉਹਦੇ ਵਿੱਚ ਸੀਗਾ ਕਿਤਾਬ ਦੇ ਵਿੱਚ ਅਤੇ ਪਿੰਡ ਦਾ ਪਿੰਡਾਂ ਦਾ ਪਿੰਡ ਦਾ ਜ਼ਿਕਰ ਉਹ ਕਰਦੇ ਹੈਗੇ ਆ ਕਿ ਪਿੰਡ ਦੇ ਵਿੱਚ ਜਦੋਂ ਲੋਕ ਇਕੱਠੇ ਕੰਮਕਾਰ ਕਰਦੇ ਨੇ ਤਾਂ ਉਹ ਕਿਵੇਂ ਇੱਕ ਦੂਜੇ ਦੀ ਗੱਲ ਨੂੰ ਜਿਹੜਾ ਉਹ ਹਾਸੇ ਦੇ ਵਿੱਚ ਪਾ ਕੇ ਅਤੇ ਸਾਰੇ ਜਿਹੜੀ ਉਹਦੇ ਵਿੱਚੋਂ ਚਿੰਤਾਵਾਂ ਦੁੱਖ ਦੂਰ ਹੁੰਦੇ ਨੇ ਬੰਦੇ ਦੇ ਤਾਂ ਉਹ ਕਿਤਾਬ ਜਿਹੜੀ ਹੈਗੀ ਆ ਉਹ ਮੈਨੂੰ ਹਮੇਸ਼ਾ ਯਾਦ ਰਹਿੰਦੀ ਹੈ ਆਉ ਹੱਸੀਏ ਕਿਤਾਬ ਦਾ ਨਾਂ ਸੀਗਾ ਅਤੇ ਉਹਦੇ ਵਿੱਚ ਉਹਦੀ ਖੂਬੀ ਇਹ ਸੀਗੀ ਕਿ ਕੋਈ ਮਤਲਬ ਜਿਹੜੀਆਂ ਤੁਸੀਂ ਕਹਿ ਲਉ ਵੀ ਘੜੀਆਂ ਹੋਈਆਂ ਕਰੇਟ ਕੀਤੀਆਂ ਹੋਈਆਂ ਚੀਜ਼ਾਂ ਨਹੀਂ ਸੀਗੀਆਂ ਜਿਹੜੀਆਂ ਆਮ ਜੀਵਨ ਦੇ ਵਿੱਚ ਸਾਡੀਆਂ ਆਮ ਛੋਟੀਆਂ ਛੋਟੀਆਂ ਗੱਲਾਂ ਆਮ ਗੱਲਾਂ ਕੰਮਾਂ ਕਾਰਾਂ ਦੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਅਤੇ ਉਹਦੇ ਵਿੱਚ ਇੱਕ ਦੂਜੇ ਨੂੰ ਜਿਹ ਉਹ ਜਿਹਦੇ 'ਚ ਸਿੱਖਣ ਨੂੰ ਵੀ ਬਹੁਤ ਕੁਛ ਮਿਲਦਾ ਅਤੇ ਹਾਸਾ ਵੀ ਆਉਂਦਾ ਬੰਦਾ ਖੁਸ਼ ਵੀ ਹੁੰਦਾ ਅਤੇ ਉਹ ਕਿਤਾਬ ਸੀਗੀ ਕਿਰਪਾਲ ਸਿੰਘ ਘੁੰਮਣ ਹੋਰਾਂ ਦੀ ਆਉ ਹੱਸੀਏ ਮੈਨੂੰ ਅੱਜ ਵੀ ਯਾਦ ਹੈ ਥੈਂਕ ਯੂ